ਜੇ ਮੈਂ ਆਪਣੇ ਖੇਤਰ ਵਿੱਚ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰਨ ਦੀ ਸੋਚ ਰਿਹਾ ਹਾਂ ਤਾਂ ਇਸ ਦਾ ਸੰਬੰਧ ਬਹੁਤ ਕੁਛ ਅੱਜ ਦੇ ਸਮਾਜਿਕ ਆਰਥਿਕ ਅਤੇ ਪ੍ਰਯੋਜਨਿਕ ਰੁਝਾਨਾਂ ਨਾਲ ਹੈ ਇੱਥੇ ਕੁਝ ਨਵੇਂ ਕਾਰੋਬਾਰ ਹਨ ਜੋ ਕਮਿਊਨਿਟੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੇ ਜਾ ਸਕਦੇ ਹਨ ਜਿਵੇਂ ਕਿ ਇੱਕ ਫਰੈਂਡਲੀ ਉਤਪਾਦ ਅਤੇ ਸੇਵਾਵਾਂ ਕਿਉਂਕਿ ਵਾਤਾਵਰਨ ਦੇ ਪ੍ਰਤੀ ਜਾਗਰੂਕਤਾ ਵੱਧ ਰਹੀ ਹੈ ਇਸ ਲਈ ਰਿਸਾਈਕਲ ਕਰਨਯੋਗ ਉਤਪਾਦ ਜਾਂ ਇਥ ਇਥਾਈਕਰਨ ਮਾਡਲਾਂ ਦੀ ਪ੍ਰਧਾਨਗੀ ਵੱਲ ਵਾਲੇ ਕਾਰੋਬਾਰ ਸ਼ੁਰੂ ਕੀਤੇ ਜਾ ਸਕਦੇ ਹਨ ਦੂਜਾ ਹੈ ਡਿਜੀਟਲ ਮਾਰਕੀਟਿੰਗ ਅਤੇ ਐਪ ਡਿਪਲੋਮਾ ਜਿਵੇਂ ਕਿ ਵਿਸ਼ਵ ਭਰ ਵਿੱਚ ਓਨਲਾਈਨ ਕਾਰੋਬਾਰ ਦੀ ਮੰਗ ਵੱਧ ਰਹੀ ਹੈ ਛੋਟੇ ਅਤੇ ਦਰਮਿਆਨੇ ਕਾਰੋਬਾਰ ਲਈ ਡਿਜੀਟਲ ਮਾਰਕੀਟਿੰਗ ਸੇਵਾਵਾਂ ਜਾਂ ਕਿਸੇ ਨਵੇਂ ਐਪ ਬਣਾਉਣ ਦੀ ਲੋੜ ਪੈ ਸਕਦੀ ਹੈ ਸਿਹਤ ਅਤੇ ਫਿਟਨੈਸ ਸੇਵਾਵਾਂ ਸਿਹਤ ਦੀ ਸੰਭਾਲ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਇਸ ਲਈ ਜਿੰਮ ਜਾਂ ਮੈਡੀਟੇਸ਼ਨ ਸ਼ੁਰੂ ਕਰਨ ਇੱਕ ਚੰਗਾ ਵਿਕਲਪ ਹੋ ਸਕਦਾ ਹੈ ਚੌਥਾ ਹੈ ਸਥਾਨਿਕ ਖੇਤੀਬਾੜੀ ਅਤੇ ਔਰਗੈਨਿਕ ਉਤਪਾਦ ਇਸ ਦੇ ਨਾਲ ਸਥਾਨਿਕ ਕਮਿਊਨਿਟੀ ਵਿੱਚ ਖੁਦ ਦੀ ਖੇਤੀ ਅਤੇ ਫਾਰਮ ਉਤਪਾਦਾਂ ਨੂੰ ਬਾਜ਼ਾਰ ਵਿੱਚ ਲਿਆ ਸਕ ਲਿਆ ਸਕਦੇ ਹੋ ਜੋ ਸਿਹਤਮੰਦ ਜੀਵਨ ਆ ਵਿਆਪਨ ਨੂੰ ਮਦਦ ਕਰ ਸਕਦੇ ਹਨ ਜੇ ਮੈਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹਾਂ ਤਾਂ ਮੈਂ ਡਿਜੀਟਲ ਸੇਵਾਵਾਂ ਜਾਂ ਸਥਾਨਕ ਔਰਗੈਨਿਕ ਖੇਤੀਬਾੜੀ ਅਤੇ ਧਿਆਨ ਦੇਣਾ ਚਾਹੁੰਦਾ ਇਹਨਾਂ ਵਿੱਚ ਵਿਕਾਸ ਯੋਗਤਾ ਹੈ ਅਤੇ ਮੈਂ ਸਮਾਜਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਲਾਭਦਾਇਕ ਸਾਬਤ ਹੋ ਸਕਦੇ ਹਨ ਅਤੇ ਅਜਿਹੇ ਬਹੁਤ ਸਾਰੇ ਕਾਰੋਬਾਰ ਹਨ ਜੋ ਕਿ ਮੈਂ ਆਪਣੇ ਖੇਤਰ ਵਿੱਚ ਪੂਰਾ ਕਰ ਸਕਦਾ ਹਾਂ ਧੰਨਵਾਦ